ਐਪਲ ਅਡਰਾਇਡ ਕਨਸੋਲ ਵਧੀਆ ਲੱਗੇ ਪਰ ਮੈਂ ਖਰੀਦਣ ਤੋਂ ਪਹਿਲਾਂ ਇਹਨਾਂ ਦੀ ਤੁਲਨਾ ਕਰਾਂਗੀ ਜਿਹੜਾ ਮੈਨੂੰ ਚੰਗਾ ਲੱਗੇਗਾ ਉਹੀ ਖਰੀਦਾਂਗੀ ਐਪਲ ਦਾ ਇੰਟਰਫੇਸ ਵਧੇਰੇ ਇੱਕ ਸਾਰ ਅਤੇ ਗੁੰਝਲਦਾਰ ਹੈ ਇਸ ਤਰ੍ਹਾਂ ਐਂਡਰਾਇਡ ਕਸਟਮਾਈਜ਼ ਕਰਨ ਲਈ ਵਧੇਰੇ ਆਜ਼ਾਦੀ ਦਿੰਦਾ ਹੈ ਆਈ ਓ ਐਸ ਐ ਐਪਲ ਆਈ ਓ ਐਸ ਗੇਮਾਂ ਆਮ ਤੌਰ 'ਤੇ ਵਧੇਰੇ ਸਥਿਰ ਹੁੰਦੀਆਂ ਅਤੇ ਗੁਣਵੱਤਾ ਵਾਲੀਆਂ ਗੇਮਾਂ ਦੀ ਇੱਕ ਵੱਡੀ ਚੋਣ ਹੁੰਦੀ ਹੈ ਇਸ ਤਰ੍ਹਾਂ ਐਂਡਰਾਇਡ ਗੇਮਾਂ ਨੂੰ ਬਾਕਸ ਦੇ ਬਾਹਰ ਕੰਟਰੋਲਰਾਂ ਨਾਲ ਜੋੜਿਆ ਜੋੜਿਆ ਜਾ ਸਕਦਾ ਹੈ ਇਸ ਤਰ੍ਹਾਂ ਐਪਲ ਟੀ ਵੀ ਬਲੂਟੂਥ ਡਿਵਾਈਸਾਂ ਨਾਲ ਕਨਵੈਂਟ ਕਨੈਕਟ ਕਰ ਸਕਦੇ ਹਾਂ ਤੁਸੀਂ ਆਪਣੇ ਆਈਫੋਨ ਆਈਪੈਡ ਜਾਂ ਐਪਲ ਵਾਚ ਨੂੰ ਰਿਮੋਟ ਕੀਬੋਰਡ ਜਾਂ ਵੈਬ ਕੈਮਰੇ ਵਜੋਂ ਵਰਤ ਸਕਦੇ ਹੋ ਇਸ ਤਰ੍ਹਾਂ ਐਡਰਾਇਰਡ ਕੰਨਸੋਲ ਕੰਟਰੋਲਰਾਂ ਦੇ ਨਾਲ ਆ ਸਕਦੇ ਸਨ ਅ ਹਨ ਐਪਲ ਟੀ ਵੀ ਆਈ ਡੀ ਆਡੀਓ ਅਤੇ ਵੀਡੀਓ ਨੂੰ ਸਟੀਮ ਕਰ ਸਕਦਾ ਹੈ ਅਤੇ ਤੁਸੀਂ ਇਸ ਦੇ ਨਾਲ ਏਅਰਪਲੇ ਸਮਰੱਥ ਸਪੀਕਰਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਐਂਡਰਾਇਡ ਹੈਂਡ ਹੋ ਹੈਂਡ ਗੇਮਇਸ ਕਨਸੋਲ ਵਿੱਚ ਟੱਚ ਸਕਰੀਨ ਪ੍ਰੋਫੈਸਰ ਪ੍ਰੋਸੈਸਰ ਰੈਮ ਹੰਦੂਰੀ ਸਟੋਰੇਜ ਅਤੇ ਇੱਕ ਮਾਈਕਰੋ ਐਸ ਡੀ ਕਾਰਡ ਸਲੋਟ ਵਰਗੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ ਆ ਆਮ ਤੌਰ 'ਤੇ ਕੰਸੋਲ ਵਿੱਚ ਵੱਡੀਆਂ ਸਕਰੀਨਾਂ ਉੱਚ ਗੁਣਵੱਤਾ ਵਾਲੇ ਗ੍ਰਾਫਿਕਸ ਹੁੰਦੇ ਹਨ ਅਤੇ ਗੇਮ ਕੰਟਰੋਲਰਾਂ ਦੀ ਵਰਤੋਂ ਕਰਕੇ ਕਈ ਕਿਰਿਆਵਾਂ ਕਰ ਸਕਦੇ ਹਾਂ ਮੋਬਾਇਲ ਵਰਤਣ ਲਈ ਆਸਾਨ ਪਹੁੰਚਣ ਯੋਗ ਅਤੇ ਆਲੇ ਦੁਆਲੇ ਲਿਜਾਏ ਜਾ ਸਕਦੇ ਹਨ ਅੱਜ ਅੱਜ ਕੱਲ੍ਹ ਮੋਬਾਇਲ ਵਿੱਚ ਹੀ ਹਰੇਕ ਤਰ੍ਹਾਂ ਦੀ ਗੇਮ ਮੌਜੂਦ ਹੈ ਅਲੱਗ ਤੋਂ ਗੇਮ ਖਰੀਦਣ ਦੀ ਲੋੜ ਨਹੀਂ ਹੁੰਦੀ